ਬੱਚਿਆਂ ਨੂੰ ਸਕੂਲ ਦੇ ਸਿਲੇਬਸ ਵਿੱਚ ਬੈਂਕ ਦੇ ਵਰਕਫਲੋ ਨੀਤੀਆਂ ਕਰਜੀਆ ਰਿਟਰਨ ਟੈਕਸ ਆਦਿ ਬਾਰੇ ਸਿਖਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਡਾ ਦੇਸ਼ ਜਾ ਕੇ ਸਾਡੀ ਦੁਨੀਆਂ ਤਰੱਕੀ ਕਰ ਰਹੀ ਹੈ ਅਤੇ ਜੇ ਬੱਚੇ ਇਸ ਚੀਜ਼ ਨੂੰ ਛੋਟੀ ਉਮਰ ਤੋਂ ਸਮਝਣ ਵੀ ਕਿ ਉਹਨਾਂ ਨੇ ਵੱਡੇ ਹੋ ਕੇ ਕਿਸ ਤਰੀਕੇ ਨਾਲ ਆਪਣਾ ਜਿਹੜਾ ਪੈਸਾ ਕਮਾਇਆ ਹੈ ਜਾਂ ਫਿਰ ਉਹਨਾਂ ਦੇ ਕ ਕਹਿ ਲਓ ਕਿ ਘਰਦਿਆਂ ਨੇ ਪੈਸੇ ਜਿਹੜਾ ਜੋੜਿਆ ਹੈ ਉਹਨੂੰ ਆਪਾਂ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਵਰਤੋਂ ਕਰੀਏ ਜਿਹਦੇ ਕਰਕੇ ਉਹਨਾਂ ਦਾ ਆਪਣਾ ਫਾਇਦਾ ਤਾਂ ਹੋਵੇ ਹੋਵੇ ਉਹਦੇ ਨਾਲ ਨਾਲ ਦੇਸ਼ ਵੀ ਤਰੱਕੀਆਂ ਕਰੇ ਜੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਟੈਕਸ ਭਰਨ ਨਾਲ ਸਾਡਾ ਦੇਸ਼ ਤਰੱਕੀ ਕਰਦੀ ਹੈ ਜਾਂ ਕਹਿ ਲਓ ਕਿ ਜੇ ਆਪਾਂ ਟੈਕਸ ਨਾ ਭਰੀਏ ਤਾਂ ਸਾਨੂੰ ਕੀ ਨੁਕਸਾਨ ਹੋ ਸਕਦਾ ਹੈ ਟੈਕਸ ਭਰਨ ਦੇ ਉਹਨਾਂ ਨੂੰ ਆਪਣਾ ਪਰਸਨਲੀ ਬੈਨੀਫਿਟ ਵੀ ਬਹੁਤ ਨੇ ਇਸ ਤਰੀਕੇ ਨਾਲ ਦੇਸ਼ ਨੂੰ ਵੀ ਫਾਇਦਾ ਹੈ ਅਤੇ ਜੇ ਆਪਾਂ ਆਹ ਚੀਜ਼ਾਂ ਨੂੰ ਛੋਟੀ ਉਮਰ ਤੋਂ ਪ ਲ ਸਿਲੇਬਸ ਦੇ ਵਿੱਚ ਐਡ ਕਰਦੇ ਹਾਂ ਤਾਂ ਬੱਚਾ ਆਪਣੇ ਲਾਈਫ ਸਟਾਈਲ ਨੂੰ ਬਹੁਤ ਈਜ਼ੀ ਆਪਣੇ ਬਹੁਤ ਸੌਖੇ ਤਰੀਕੇ ਨਾਲ ਆਪਣੇ ਆਪ ਨੂੰ ਸਮਾਜ ਦੇ ਵਿੱਚ ਪੇਸ਼ ਕਰ ਸਕਦਾ ਹੈ ਕਿਉਂਕਿ ਉਹ ਇੱਕ ਸਮਝਦਾਰ ਅਤੇ ਇੱਕ ਕਾਬਲ ਨਾਗਰਿਕ ਬਣ ਜਾਂਦਾ ਹੈ ਜਦੋਂ ਉਹਨੂੰ ਪਤਾ ਹੋਵੇ ਕਿ ਅਸੀਂ ਟੈਕਸ ਪੇ ਕਰਦੇ ਹਾਂ ਆਪਾਂ ਬਾਕੀ ਜਿੱਦਾਂ ਵੀ ਕਹਿ ਲਓ ਕਿ ਕਰਜ ਕਿੱਦਾਂ ਆਪਾਂ ਕਰਦੇ ਹਾਂ ਨੀਤੀਆਂ ਕੀ ਨੇ ਇਹਦੀਆਂ ਉਹ ਸਭ ਸਮਝਦੇ ਹੋਏ ਉਹ ਅਗਾਂਹ ਤੋਂ ਪ੍ਰੇਸ਼ਾਨ ਨਹੀਂ ਹੋ ਸਕਦਾ ਉਹਨੇ ਜੋ ਵੀ ਕਰਨਾ ਆਪਣੇ ਆਪਣੇ ਹਿਸਾਬ ਨਾਲ ਕਰੂੰਗਾ ਕਿ ਮੈਂ ਕਿੱਥੇ ਕਦੋਂ ਕਿੱਦਾਂ ਕੀ ਅਪਲਾਈ ਕਰਨਾ ਹੈ ਅਤੇ ਇਸ ਕਰਕੇ ਸਿਖਾਉਣਾ ਬਹੁਤ ਜ਼ਰੂਰੀ ਆ ਅਤੇ ਸਕੂਲ ਦੇ ਸਿਲੇਬਸ ਦੇ ਵਿੱਚ ਇਹ ਨੂੰ ਐਡ ਕਰਨਾ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਆ